ਮੇਰਾ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਰੂਟ ਜਿੱਥੇ ਮੈਂ ਆਪਣੇ ਸਾਈਕਲ 'ਤੇ ਨਜਿੱਠਿਆ ਸੀ ਉਹ ਮੇਰਾ ਲੇਹ ਲਦਾਖ ਦਾ ਸਾਈਕਲ ਦਾ ਟੂਰ ਸੀ ਜਿਹਨੂੰ ਕਿ ਮੈਂ ਘੱਟੋ ਘੱਟ ਆਣ ਜਾਣ ਪੰਦਰਾਂ ਦਿਨ ਲੱਗ ਗਏ ਸੀ ਉਹਦੇ ਵਿੱਚ ਕੀ ਹੋਇਆ ਕਿ ਮੈਨੂੰ ਤਾਂ ਚੁਣੌਤੀਆਂ ਬੜੀਆਂ ਪੇਸ਼ ਹੋਈਆਂ ਜਿੱਦਾਂ ਕਿ ਮੈਨੂੰ ਆਪਣਾ ਸਮਾਨ ਵੀ ਸਾਈਕਲ 'ਤੇ ਲੱਦ ਕੇ ਜਾਣਾ ਪਿਆ ਮੈਨੂੰ ਕਾਫ਼ੀ ਜ਼ੋਰ ਜ਼ੋਰ ਨਾਲ ਖਿੱਚਣਾ ਪੈਂਦਾ ਸੀ ਦੂਜਾ ਕਿ ਜਦੋਂ ਪਹਾੜੀ ਇਲਾਕੇ 'ਤੇ ਜਾਣਾ ਪੈਂਦਾ ਸੀ ਤਾਂ ਉੱਥੇ ਸਾਹ ਵੀ ਚੜ ਜਾਂਦਾ ਸੀ ਅਤੇ ਰਸਤੇ 'ਚ ਜਦੋਂ ਕਿਤੇ ਬਾਰਿਸ਼ ਹੋ ਜਾਣੀ ਅਤੇ ਮੈਨੂੰ ਹੋਟਲ ਵਗੈਰਾ ਨਾ ਮਿਲਣਾ ਤਾਂ ਮੈਨੂੰ ਟੈਂਟ ਲਗਾ ਕੇ ਵੀ ਰਹਿਣਾ ਪੈਂਦਾ ਸੀ ਨਾਲੇ ਮੇਰਾ ਉੱਥੇ ਖਾਣ ਪੀਣ ਰਸਤੇ ਵੀ ਕਿਸੇ ਵੇਲੇ ਦਿੱਕਤ ਆ ਜਾਂਦੀ ਸੀ ਜਿਹੜੀ ਕਿ ਮੈਂ ਆਪਣੇ ਆਪ ਜਿੱਦਾਂ ਮੈਗੀ ਬਣਾ ਕੇ ਖਾ ਲਈ ਦੀ ਸੀ ਰਸਤੇ 'ਚ ਨਾਲੇ ਕਿ ਰਸਤੇ 'ਚ ਰਸਤੇ ਕਿਸੇ ਵੇਲੇ ਪਾਣੀ ਨਾਲ ਖ਼ਰਾਬ ਹੋ ਜਾਂਦੇ ਸੀ ਜਿਹਦੇ ਕਰਕੇ ਰਾਹ ਰੁਕ ਜਾਂਦੇ ਸੀ ਪਰ ਫਿਰ ਵੀ ਮੈਂ ਬੜੇ ਹੀ ਹਿੰਮਤ ਦੇ ਨਾਲ ਇਹ ਆਪਣਾ ਜਿਹੜਾ ਮੇਰਾ ਟੂਰ ਸੀਗਾ ਲੇਹ ਲਦਾਖ ਦਾ ਕੰਪਲੀਟ ਕਰਕੇ ਮੈਂ ਫਿਰ ਵਾਪਸ ਆ ਗਿਆ ਧੰਨਵਾਦ ਜੀ